ਹੈਲੋ ਮੈਮ ਮੈਂ ਨਿਰਵੈਰ ਸਿੰਘ ਬੋਲ ਰਿਹਾ ਜੀ ਤੁਸੀਂ ਅੰਮ੍ਰਿਤਸਰ ਤੋਂ ਬੋਲ ਰਹੇ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਜੀ ਪੰਜਾਬ ਤੋਂ ਪੰਜਾਬ ਤੋਂ ਬਾਹਰ ਰਹਿੰਦਾ ਹਾਂ ਮੈਂ ਅਤੇ ਮੈਨੂੰ ਨਾ ਤੁਸੀਂ ਕੁਛ ਸਿੱਖੀ ਬਾਰੇ ਦੱਸ ਸਕਦੇ ਇੱਥੋਂ ਬਈ ਕਿਵੇਂ ਕਿਉਕਿ ਮੈਨੂੰ ਜ਼ਿਆਦਾ ਪਤਾ ਨਹੀਂ ਆ ਅਤੇ ਮੈਂ ਤੁਹਾਡੇ ਕੋਲੋਂ ਜਾਣਕਾਰੀ ਲੈਣ ਵਾਸਤੇ ਮੈਂ ਤੁਹਾਨੂੰ ਕਾਲ ਕੀਤੀ ਸੀ ਕਿ ਤੁਸੀਂ ਮੈਨੂੰ ਜਾਣਕਾਰੀ ਪਲੀਜ਼ ਦੱਸ ਦਿਓ ਕਿ ਇੱਥੇ ਕਿਵੇਂ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਅੱਛਾ ਦਸ ਗੁਰੂ ਅੱਛਾ ਠੀਕ ਹੈ ਅਤੇ ਮੈਂ ਮੈਂ ਤੁਹਾਡੇ ਕੋਲੋਂ ਇੱਕ ਹੋਰ ਜਾਣਕਾਰੀ ਲੈਣੀ ਸੀਗੀ ਅਤੇ ਮੈਂ ਸੁਣਿਆ ਇੱਥੇ ਕਹਿੰਦੇ ਲੰਗਰ ਫਰੀ ਮਿਲਦੈ ਪੈਸੇ ਨਹੀਂ ਅੱਛਾ ਜੀ ਹਾਂਜੀ ਹਾਂ ਠੀਕ ਹੈ ਜੀ ਅੱਛਾ

ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਓਕੇ ਠੀਕ ਹੈ ਜੀ